ਜਿਵੇਂ ਅਸੀਂ ਪਹਿਲਾਂ ਸਭ ਨੂੰ ਮਿਲਣ ਜਾਂਦੇ ਸੀ ਲੇਕਿਨ ਅੱਜ ਕੱਲ੍ਹ ਟੈਕਨੋਲੋਜੀ ਰਾਹੀਂ ਅਸੀਂ ਵੀਡੀਓ ਕਾਲ 'ਤੇ ਹੀ ਸਭ ਨੂੰ ਮਿਲ ਲੈਂਦੇ ਹਨ ਉਸ ਕਰਕੇ ਸਾਨੂੰ ਲੋੜ ਹੀ ਨਹੀਂ ਪੈਂਦੀ ਕਿ ਅਸੀਂ ਜਾ ਕੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਣ ਨਾਲ ਹੀ ਨਾਲ ਸਾਡੇ ਪਰਿਵਾਰ ਵਿੱਚ ਵੀ ਸਭ ਆਪਣੇ ਫ਼ੋਨਾਂ ਵਿੱਚ ਲੱਗੇ ਰਹਿੰਦੇ ਹਨ ਅਤੇ ਕੋਈ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਦਾ